ਹੈਲੋ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਤੁਸੀਂ ਦੱਸੋ ਠੀਕ ਹੋ ਹਾਂਜੀ ਹੋਰ ਕੀ ਕਰ ਰਹੇ ਸੀ ਹਾਂਜੀ ਹਾਂਜੀ ਦੱਸੋ ਕੀ ਦਿੱਕਤ ਆ ਰਹੀ ਹੈ ਤੁਹਾਨੂੰ ਲਿਖਣ 'ਚ ਕੀ ਲਿਖਣ ਦਾ ਟਰਾਈ ਕਰ ਰਹੇ ਹੋ ਕੁਛ ਲੇਖ ਲਿਖ ਰਹੇ ਹੋ ਕਵਿਤਾ ਲਿਖ ਰਹੇ ਹੋ ਜਾਂ ਕੋਈ ਸ਼ਾਇਰੀ ਲਿਖ ਰਹੇ ਕਵਿਤਾ ਲਿਖ ਰਹੇ ਹੋ ਠੀਕ ਹੈ ਜੀ ਹਾਂਜੀ ਕੀ ਦਿੱਕਤ ਆ ਰਹੀ ਹੈ ਕੋਈ ਮਤਲਬ ਲਾਈਨ ਨਹੀਂ ਬਣ ਰਹੀ ਜਾਂ ਮਤਲਬ ਹਾਂਜੀ ਤੁਸੀਂ ਕਿਸ ਟੌਪਿਕ 'ਤੇ ਲਿਖ ਰਹੇ ਹੋ ਕਵਿਤਾ ਅੱਛਾ ਜੀ ਠੀਕ ਹੈ ਜੀ ਭਗਤੀ ਇਹ ਕਵਿਤਾ ਜਦੋਂ ਆਪਾਂ ਲਿਖਦੇ ਹਾਂ ਨਾ ਇਹ ਥੋੜ੍ਹਾ ਜਿਹਾ ਮਤਲਬ ਕਈ ਵਾਰ ਆਪਣੇ ਅੰਦਰੋਂ ਹੁੰਦਾ ਹੈ ਵੀ ਕੁਛ ਆਪਾਂ ਮਹਿਸੂਸ ਕਰ ਰਹੇ ਹਾਂ ਉਭਾਰ ਦੇ ਭਾਵਾਂ ਨੂੰ ਪ੍ਰਗਟ ਕਰਨ ਲਈ ਉਹਨੂੰ ਆਪਾਂ ਉਹਨੂੰ ਲਿਖਤੀ ਰੂਪ ਵਿੱਚ ਲਿਖਦੇ ਹਾਂ ਤੁਸੀਂ ਮਤਲਬ ਜਿਵੇਂ ਤੁਹਾਨੂੰ ਕੁਛ ਵਧੀਆ ਲੱਗਦਾ ਭਗਤੀ ਰਿਲੇਟਡ ਤੁਹਾਨੂੰ ਮਤਲਬ ਆਪਣੇ ਗੁਰੂ ਨਾਲ ਪਿਆਰ ਆ ਤਾਂ ਤੁਸੀਂ ਉਸ ਨੂੰ ਮਤਲਬ ਲਾਈਨਾਂ ਵਿੱਚ ਲਿਖ ਸਕਦੇ ਹੋ ਜਿਵੇਂ ਜਿਵੇਂ ਹੋ ਗਿਆ ਮਤਲਬ ਭਗਤੀ ਦਾ ਰੰਗ ਚੜਿਆ ਉਹ ਦੂਰ ਹੋਵਾਂ ਦੁਨੀਆਂ ਵਿੱਚ ਨਾ ਚੂਰ ਹੋਵਾਂ ਇਹ ਐਗਜਾਂਪਲਾਂ ਆ ਜਾਂਦੀਆਂ ਹੈਂ ਜਿਵੇਂ ਕਿਸੇ ਸੰਗਤ ਰਿਲੇਟਡ ਹੈਗੇ ਹਾਂ ਸੰਗਤ ਮੇਰੀ ਮਾਂ ਹੈ ਮੈਂ ਸੰਗਤ ਦਾ ਬੱਚਾ ਪਤਾ ਐਵੇਂ ਹੈ ਦਿਲ 'ਚ ਮਤਲਬ ਜਿਸ ਜਿਸ ਚੀਜ਼ ਨਾਲ ਤੁਹਾਨੂੰ ਪਿਆਰ ਹੈ ਇਸ ਤਰ੍ਹਾਂ ਲਿਖ ਸਕਦੇ ਹੋ ਤੁਸੀਂ ਹਾਂਜੀ ਅੱਛਾ ਠੀਕ ਹੈ ਬਾਕੀ ਤੁਸੀਂ ਹੁਣ ਮਤਲਬ ਕਿਸੇ ਚੀਜ਼ ਨੂੰ ਜਿੰਨਾ ਟੈਮ ਫੀਲ ਨਹੀਂ ਕਰਦੇ ਹੈ ਨਾ ਮਤਲਬ ਬਾਹਰ ਜਾ ਕੇ ਦੇਖੋ ਆਸੇ ਪਾਸੇ ਕੀ ਹੋ ਰਿਹਾ ਜਾਂ ਤੁਸੀਂ ਨੇਚਰ ਰਿਲੇਟਡ ਕੁਛ ਲਿਖ ਰਹੇ ਹੋ ਆਸੇ ਆਪੇ ਦੇਖੋ ਪੰਛੀ ਉੱਡ ਰਹੇ ਆ ਹੈ ਨਾ ਅਤੇ ਤੁਹਾਨੂੰ ਮਤਲਬ ਹਵਾਵਾਂ 'ਚ ਕੀ ਮਤਲਬ ਵਧੀਆ ਵਧੀਆ ਫੀਲ ਹੋ ਰਿਹਾ ਉਸ ਚੀਜ਼ ਨੂੰ ਆਪੇ ਹੀ ਫਿਰ ਤੁਹਾਨੂੰ ਲਿਖਤੀ ਰੂਪ ਵਿੱਚ ਲਿਖਣਾ ਆ ਜਾਵੇਗਾ ਬਾਕੀ ਤੁਸੀਂ ਹਾਂਜੀ ਹਾਂਜੀ ਹਾਂਜੀ ਤੁਸੀਂ ਆਸੇ ਪਾਸੇ ਅ ਵਧੀਆ ਇਨਵਾਇਰਮੈਂਟ ਵਿੱਚ ਜਾਊਂਗੇ ਨਾ ਤੁਹਾਨੂੰ ਆਪੇ ਫੀਲ ਆ ਜਾਵੇਗੀ ਵੀ ਕਿਵੇਂ ਲਿਖਣਾ ਹੈਗਾ ਆਪੇ ਹੀ ਦਿਮਾਗ ਫਰੈਸ਼ ਹੋ ਜਾਂਦਾ ਨਾ ਉਦੋਂ ਆਪੇ ਲਾਈਨਾਂ ਵੀ ਤੁਹਾਨੂੰ ਆ ਜਾਣਗੀਆਂ ਵੀ ਕਿਵੇਂ ਲਿਖਣੀਆਂ ਹਾਂਜੀ ਹਾਂਜੀ ਹਾਂਜੀ ਬਾਕੀ ਜੇ ਤੁਹਾਨੂੰ ਹਾਂਜੀ ਹਾਂਜੀ ਜੇ ਤੁਹਾਨੂੰ ਦੁਆਰਾ ਵੀ ਲੋੜ ਹੋਈ ਤਾਂ ਤੁਸੀਂ ਦੁਬਾਰਾ ਕੌਲ ਕਰ ਲਿਓ ਠੀਕ ਹੈ ਠੀਕ